ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਮੈਂ ਕਦੋਂ ਦੀ ਕੈਬ ਬੁੱਕ ਕੀਤੀ ਹੋਈ ਆ ਆਪਣੇ ਮਾਡਲ ਟਾਊਨ ਟੂ ਇੰਡੀਆ ਗੇਟ ਤੱਕ ਅਤੇ ਮੈਂ ਕਦੋਂ ਦੀ ਇੱਥੇ ਵੇਟ ਕੀਤੀ ਜਾ ਰਹੀ ਹੈ ਮੇਰੇ ਪੂਰੇ ਫੈਮਲੀ ਮੈਂਬਰ ਇੱਥੇ ਵੇਟ ਕਰ ਰਹੇ ਹੈ ਅਤੇ ਤੁਹਾਡੀ ਉਦੋਂ ਦੀ ਕੈਬ ਨਹੀਂ ਆਈ ਮੈਂ ਓਲਾ ਵਾਲੇ ਕੰਪਨੀ ਵਿੱਚ ਵੀ ਇੰਨੇ ਕੋਲ ਕੀਤੇ ਹੈ ਤਾਂ ਤੁਸੀਂ ਕੀ ਕੀਤਾ ਹੋਇਆ ਕਿ ਮੇਰਾ ਨੰਬਰ ਹੀ ਤੁਸੀਂ ਬਿਜ਼ੀ ਕਰ ਦਿੱਤਾ ਗਿਆ ਹੋਇਆ ਕਿ ਪਤਾ ਨਹੀਂ ਬਲੋਕ ਕਰ ਦਿੱਤਾ ਗਿਆ ਹੋਇਆ ਤਾਂ ਮੈਂ ਦੂਜੇ ਨੰਬਰ ਤੋਂ ਕਾਲ ਕਰ ਰਹੀ ਹਾਂ ਇੱਦਾਂ ਥੋੜ੍ਹੀ ਕਰਨਾ ਚਾਹੀਦਾ ਆਪਾਂ ਕਦੋਂ ਦੀ ਵੇਟ ਕਰ ਰਹੇ ਹਾਂ ਜਾਂ ਤਾਂ ਤੁਸੀਂ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਕਿ ਨਹੀਂ ਆਪਾਂ ਲੇਟ ਹੋ ਜਾਣਾ ਜਾਂ ਸਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਨਹੀਂ ਨਹੀਂ ਇੱਦਾਂ ਥੋੜ੍ਹੀ ਕਰਨਾ ਚਾਹੀਦਾ ਇਹ ਤਾਂ ਤੁਹਾਨੂੰ ਪਹਿਲੇ ਦੱਸਣਾ ਚਾਹੀਦਾ ਨਾ ਕਿ ਸਾਡਾ ਪੂਰਾ ਫੈਮਲੀ ਮੈਂਬਰ ਦਾ ਟ੍ਰਿਪ ਸੀ ਇੱਕ ਤਾਂ ਛੁੱਟੀ ਨਹੀਂ ਮਿਲਦੀ ਜਦੋਂ ਛੁੱਟੀ ਮਿਲਦੀ ਹੈ ਤਾਂ ਉਦੋਂ ਇਹ ਕੰਮ ਹੋ ਜਾਵੇ ਇਹ ਤਾਂ ਬਹੁਤ ਹੀ ਜਾ ਘਟੀਆ ਕੰਮ ਹੋਇਆ ਨਾ ਇੱਕ ਤਾਂ ਆਪਾਂ ਤੁਹਾਡੇ 'ਤੇ ਟਰੱਸਟ ਕਰਦੇ ਹਾਂ ਅਤੇ ਤੁਸੀਂ ਉਸ ਟਰੱਸਟ ਦਾ ਇਹ ਗ਼ਲਤ ਤਰੀਕਾ ਚੁੱਕਦੇ ਹੋ ਇਹ ਤਾਂ ਬਹੁਤ ਹੀ ਗ਼ਲਤ ਗੱਲ ਹੈ ਨਾ ਨਹੀਂ ਤੁਸੀਂ ਪਹਿਲਾਂ ਵੀ ਤਾਂ ਇਨਫੋਰਮ ਕਰ ਹੀ ਸਕਦੇ ਸੀਗੇ ਨਾ ਕਿ ਨਹੀਂ ਆਪਾਂ ਸਾਨੂੰ ਇਹ ਜ਼ਰੂਰੀ ਕੰਮ ਪੈ ਗਿਆ ਨਾ ਤੁਸੀਂ ਇਨਫੋਰਮ ਕੀਤਾ ਈਵਨ ਤੁਸੀਂ ਸਾਡਾ ਨੰਬਰ ਹੀ ਬਿਜ਼ੀ ਕਰ ਦਿੱਤਾ ਤਾਂ ਮੈਂ ਦੂਜੇ ਆਪਣੇ ਘਰ ਦੇ ਮੈਂਬਰਾਂ ਤੋਂ ਦੇ ਨੰਬਰ ਤੋਂ ਕਾਲ ਕੀਤੀ ਹੈ ਅਤੇ ਤੁਸੀਂ ਹੁਣ ਇਹ ਇੰਨਾ ਕੁ ਨਹੀਂ ਨਹੀਂ ਤੁਸੀਂ ਇੱਦਾਂ ਕਰੋ ਕਿ ਤੁਸੀਂ ਜਿੰਨੇ ਵੀ ਪੈਸੇ ਤੁਹਾਨੂੰ ਦਿੱਤੇ ਹੋਏ ਆ ਨਾ ਉਹ ਤੁਸੀਂ ਰਿਫੰਡ ਕਰਦੋ ਹੁਣ ਕੋਈ ਚਾਂਸ ਹੀ ਨਹੀਂ ਬਣਦਾ ਜਾਣ ਦਾ ਪਹਿਲਾਂ ਬਣਦਾ ਸੀ ਹੁਣ ਤਾਂ ਇੰਨਾ ਟਾਈਮ ਹੋ ਗਿਆ ਕਦੋਂ ਦੀ ਵੇਟ ਕੀਤੀ ਹੈ ਠੀਕ ਹੈ ਤੁਸੀਂ ਰਿਫੰਡ ਕਰਦੋ ਓਕੇ ਧੰਨਵਾਦ